ਹੈਲੋ ਹਾਂਜੀ ਆਪਕਾ ਹਮਾਰੀ ਸ਼ੋਪ ਮੇਂ ਸਵਾਗਤ ਹੈ ਬਤਾਈਏ ਆਪਕੋ ਹਮ ਕਿਆ ਕਿਆ ਬਤਾ ਸਕਦੇ ਹੈ ਹਾਂਜੀ ਹਮ ਕਾਫੀ ਐਂਡ ਟੀ ਸ਼ੋਪ ਸੇ ਬਾਤ ਕਰ ਰਹੇ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਸ਼ੋਪ ਨੂੰ ਪ੍ਰੈਫਰ ਕੀਤਾ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਟੀ ਬਾਰੇ ਦੱਸਣਾ ਚਾਵਾਂਗੀ ਸਾਡੇ ਕੋਲ ਗਰੀਨ ਟੀ ਬਲੂ ਟੀ ਅਤੇ ਇੱਕ ਸਿੰਪਲ ਮਿਲਕ ਵਾਲੀ ਟੀ ਹੋਵੇਗੀ ਜੀ ਅਤੇ ਉਸ ਦੇ ਨਾਲ ਹੀ ਕੋਫੀ ਦੇ ਵਿੱਚ ਕੋਲਡ ਕਾਫੀ ਹੈਗੀ ਆ ਸਾਡੇ ਕੋਲ ਹੋਟ ਕਾਫੀ ਅਤੇ ਕੋਲਡ ਕਾਫੀ ਵਿਦ ਆਈਸ ਕ੍ਰੀਮ ਕੋਲਡ ਕਾਫੀ ਵਿਦ ਕੈਪੇਚੀਨੋ ਮੈਮ ਸਾਡੀ ਸ਼ੋਪ 'ਤੇ ਤਾਂ ਸਾਰੀਆਂ ਹੀ ਹੈਲਥ ਨਾਲ ਹੈਲਥ ਨੂੰ ਆਪਾਂ ਨੂੰ ਵਧੀਆ ਰੱਖੇ ਉਹ ਜਿਹੀ ਅਸੀਂ ਆਈਟਮ ਵਰਤਦੇ ਹਾਂ ਵੀ ਕਸਟਮਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮਸ ਨਾ ਹੋਵੇ ਇੰਨ ਫਿਊਚਰ ਜੇ ਤੁਸੀਂ ਡਾਇਟ ਪਲਾਨ ਫੋਲੋ ਕਰ ਰਹੇ ਹੋ ਫਿਰ ਤੁਸੀਂ ਗਰੀਨ ਟੀ ਪੀ ਸਕਦੇ ਹੋ ਬਲੂ ਟੀ ਪੀ ਸਕਦੇ ਹੋ ਹਾਂਜੀ ਲਿਪਟਿੰਗ ਗੀ ਗਰੀਨ ਟੀ ਭੀ ਹੈ ਹਮਾਰੇ ਪਾਸ ਅਵੇਲੇਬਲ ਹਾਂਜੀ ਲਿਪਟਿੰਨ ਗਰੀਨ ਟੀ ਤੁਹਾਨੂੰ ਪਵੇਗੀ ਜੀ ਪੰਜਾਹ ਰੁਪਏ ਪਰ ਕੱਪ ਕੋਫੀ ਤੁਸੀਂ ਮੈਨੂੰ ਦੱਸੋਗੇ ਬੀ ਤੁਹਾਡੀ ਚੋਇਸ ਕਿਹੜੀ ਹੈਗੀ ਹੈ ਜੀ ਸਾਡੇ ਕੋਲ ਕੋਫੀ ਦੇ ਵਿੱਚ ਕੋਲਡ ਹੋਟ ਕੋਫੀ ਕੋਫੀ ਵਿਦ ਆਈਸ ਕ੍ਰੀਮ ਕੋਲਡ ਕੋਫੀ ਵਿਦ ਕੈਪੇਚੀਨੋ ਹੋਟ ਕੋਫੀ ਨੈਸਲੇਅ ਦਾ ਪ੍ਰਾਈਜ਼ ਹੈ ਜੀ ਅੱਸੀ ਰੁਪਏ ਪਰ ਕੱਪ ਮੈਮ ਸਾਡੀ ਜਿਹੜੀ ਸ਼ੋਪ ਹੈ ਉਹ ਸਵੇਰੇ ਛੇ ਵਜੇ ਓਪਨ ਹੋ ਜਾਂਦੀ ਹੈ ਅਤੇ ਰਾਤ ਨੂੰ ਦਸ ਵਜੇ ਤੱਕ ਓਪਨ ਰਹਿੰਦੀ ਹੈ ਵਿਚਕਾਰ ਇੱਕ ਘੰਟੇ ਦਾ ਬ੍ਰੇਕ ਹੁੰਦਾ ਹੈ ਜੀ ਦਸ ਤੋਂ ਗਿਆਰਾਂ ਵਜੇ ਹਾਂਜੀ ਜੀ ਕੋਲਡ ਕੌਰ ਕੋਲਡ ਕਾਫੀ ਸਿੰਪਲ ਦੇ ਵਿੱਚ ਤੁਹਾਨੂੰ ਮਿਲੇਗੀ ਜੀ ਸੌ ਰੁਪਏ ਪਰ ਕੱਪ ਅਤੇ ਕੋਲਡ ਕਾਫੀ ਵਿਦ ਕੈਪੋਚੀਨੋ ਵਨ ਟਵੰਟੀ ਐਂਡ ਕੋਲਡ ਕਾਫੀ ਵਿਦ ਆਇਸ ਕ੍ਰਿਮ ਵਨ ਫੀਫਟੀ ਹਾਂਜੀ ਮਿਲ ਸਕਦਾ ਜੀ ਤੁਸੀਂ ਮੈਨੂੰ ਇਸ ਨੰਬਰ 'ਤੇ ਵਟਸਐਪ ਕਰ ਦਿਓ ਮੈਂ ਤੁਹਾਨੂੰ ਭੇਜ ਦਿੰਦੀ ਹਾਂ ਓਕੇ ਜੀ